ਸ਼ਹੀਦ ਭਗਤ ਸਿੰਘ ਉਦਯੋਗ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਹਨ ਜਿਨ੍ਹਾਂ ਫੈਕਟਰੀਆਂ ਦੇ ਨਾਂ ਹਨ ਡੀ ਸੀ ਐੱਮ ਮੈਕਸ ਇੰਡੀਆ ਸਵਰਾਜ ਮਹਿਕਮਾ ਕੈਪਸੂਲ ਫੈਕਟਰੀ ਜਿਵੇਂ ਕਿ ਮੈਕਸ ਇੰਡੀਆ ਫੈਕਟਰੀ ਵਿੱਚ ਦਵਾਈਆਂ ਬਣਦੀਆਂ ਹਨ ਕੈਪਸੂਲ ਬਣਦੇ ਹਨ ਅਤੇ ਸਨ ਫਾਰਮ ਫੈਕਟਰੀ ਵੀ ਹੈ ਜਿਸ ਵਿੱਚ ਕੱਪੜੇ ਬਣਦੇ ਹਨ ਅਤੇ ਦਵਾਈਆਂ ਕਾਫੀ ਸਾਰੀਆਂ ਬਣਦੀਆਂ ਹਨ ਇਸ ਕਰਕੇ ਫੈਕਟਰੀਆਂ ਵਿੱਚ ਬਹੁਤ ਸਾਰੇ ਕੱਪੜੇ ਬਣਦੇ ਹਨ ਜਿਵੇਂ ਕਿ ਸਵਰਾਜ ਮਹਿਕਮਾ ਵਿੱਚ ਬੱਸਾਂ ਬਣਦੀਆਂ ਹਨ ਬਹੁਤ ਸਾਰੀਆਂ ਬੱਸਾਂ ਬਣਦੀਆਂ ਹਨ ਸਵਰਾਜ ਮਹਿਕਮਾ ਫੈਕਟਰੀ ਵਿੱਚ ਅਤੇ ਇਸ ਫੈਕਟਰੀ ਵਿੱਚ ਬਹੁਤ ਹੀ ਇੱਕ ਦਿਨ ਵਿੱਚ ਦੋ ਢਾਈ ਸੌ ਬੱਸ ਬਣ ਜਾਂਦੀ ਹਨ ਅਤੇ ਮੈਕਸ ਇੰਡੀਆ ਫੈਕਟਰੀ ਵਿੱਚ ਕੈਪਸੂਲ ਦਵਾਈਆਂ ਬਣਦੀਆਂ ਹਨ ਅਤੇ ਸਵਰਾਜ ਮਹਿ ਫਾਰਮਾ ਵਿੱਚ ਬਹੁਤ ਹੀ ਸਾਰੀਆਂ ਦਵਾਈਆਂ ਬਣਦੀਆਂ ਹਨ ਅਤੇ ਇਸ ਫੈਕਟਰੀਆਂ ਸਾਡੇ ਬਹੁਤ ਹੀ ਨਜ਼ਦੀਕ ਹੈ ਅਤੇ ਇਹਨਾਂ ਕ ਇਹਨਾਂ ਫੈਕਟਰੀਆਂ ਕਰਕੇ ਲੋਕਾਂ ਦਾ ਰੋਜ਼ੀ ਰੋਟੀ ਕੰਮ ਚੱਲਿਆ ਹੋਇਆ ਹੈ ਅਤੇ ਇਸ ਫੈਕਟਰੀਆਂ ਰਾਹੀਂ ਸਾਨੂੰ ਬਹੁਤ ਹੀ ਲਾਭਦਾਇਕ ਹਨ ਅਤੇ ਇਸ ਫੈਕਟਰੀਆਂ ਕਰਕੇ ਸਾਡਾ ਸਕੂਲ 'ਚ ਵੀ ਬਹੁਤ ਹੀ ਸਾਰਾ ਸਮਾਨ ਦੇ ਜਾਂਦੇ ਹਨ ਇਸ ਫੈਕਟਰੀ ਕਰਕੇ ਸਾਡਾ ਬਹੁਤ ਹੀ ਸਮਾਨ ਸਕੂਲਾਂ ਵਿੱਚ ਪਹੁੰਚਾ ਦਿੰਦੇ ਹਨ ਅਤੇ ਸਕੂਲਾਂ ਦੀ ਵੀ ਮਦਦ ਕਰਦੇ ਹਨ ਫੈਕਟਰੀਆਂ ਵਾਲ਼ੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹਨ ਅਤੇ ਇਸ ਕਰਕੇ ਇਹ ਫੈਕਟਰੀਆਂ ਬਹੁਤ ਹੀ ਵਧੀਆ ਹਨ ਇਹਨਾਂ ਕਰਕੇ ਸਾਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਹ ਫੈਕਟਰੀਆਂ ਦਾ ਬਹੁਤ ਹੀ ਸੇਫਟੀ ਅਤੇ ਧਿਆਨ ਨਾਲ਼ ਸਾਰੇ ਕੰਮ ਕਰਦੇ ਹਨ ਅੰਦਰ ਇਨ੍ਹਾਂ ਫੈਕਟਰੀਆਂ ਵਿੱਚ ਘੱਟੋ ਘੱਟ ਦਸ ਹਜ਼ਾਰ ਬੰਦਾ ਕੰਮ ਕਰਦਾ ਹੈ ਡੇਲੀ ਦਾ ਅਤੇ ਇਹ ਫੈਕਟਰੀਆਂ ਬਹੁਤ ਹੀ ਮਸ਼ਹੂਰ ਹਨ ਦੂਰ ਦੂਰ ਤੋਂ ਇਨ੍ਹਾਂ ਫੈਕਟਰੀਆਂ ਵਿੱਚ ਲੋਕ ਕੰਮ ਕਰਨ ਲਈ ਆਉਂਦੇ ਹਨ